ਤੁਸੀਂ ਕੈਬ ਦਫਤਰ ਤੋਂ ਗੱਲ ਕਰ ਰਹੇ ਹੋ ਮੈਂ ਅੰਮ੍ਰਿਤਸਰ ਤੋਂ ਮਾਨਸਾ ਵਾਸਤੇ ਇੱਕ ਕੈਬ ਬੁੱਕ ਕਰਾਉਣੀ ਸੀ ਮੈਨੂੰ ਇਹ ਵੀ ਦੱਸੋ ਕਿ ਕੈਬ ਵਾਸਤੇ ਕਿੰਨਾ ਕੁ ਟਾਈਮ ਲੱਗੇਗਾ ਕਿਉਂਕਿ ਅੱਜ ਕੱਲ੍ਹ ਜਿਵੇਂ ਮਾਰਕੀਟ ਦੇ ਵਿੱਚ ਇੰਨੀਆਂ ਸਾਰੀਆਂ ਐਪ ਆ ਚੁੱਕੀਆਂ ਹਨ ਜਿਵੇਂ ਕਿ ਓਲਾ ਅਤੇ ਉਬਰ ਜਿਹਦੇ ਕਰਕੇ ਸਾਨੂੰ ਪਤਾ ਲੱਗ ਜਾਂਦਾ ਕਿ ਕਿੱਥੋਂ ਕਿੰਨੇ ਟਾਈਮ ਤੱਕ ਅਸੀਂ ਪਹੁੰਚ ਸਕਦੇ ਹਾਂ ਇੱਕ ਤੋਂ ਦੂਜੀ ਜਗ੍ਹਾ ਦੇ ਵਿੱਚ ਹੁਣ ਅੱਜ ਦੀ ਇਹ ਇਹ ਇਸ ਦੇ ਵਿੱਚ ਸਾਨੂੰ ਅਸੀਂ ਆਪਣਾ ਡਰਾਈਵਰ ਵੀ ਪਤਾ ਹੁੰਦਾ ਹੈ ਜਿਸ ਕਰਕੇ ਅਸੀਂ ਬਹੁਤ ਹੀ ਸੁਰੱਖਿਅਤ ਮਹਿਸੂਸ ਕਰਦੇ ਹਾਂ ਸਾਨੂੰ ਕੋਈ ਵੀ ਫਿਕਰ ਨਹੀਂ ਹੁੰਦੀ ਸਾਡੇ ਮਾਂ ਬਾਪ ਨੂੰ ਵੀ ਕੋਈ ਫਿਕਰ ਨਹੀਂ ਹੁੰਦੀ ਕਿਉਂਕਿ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਬਿਲਕੁਲ ਆਸਾਨੀ ਨਾਲ ਅਤੇ ਬਿਲਕੁਲ ਸੁਰੱਖਿਅਤ ਤੌਰ 'ਤੇ ਮਹਿਸੂਸ ਕਰਕੇ ਫਿਰ ਹੀ ਪਹੁੰਚਦੇ ਹਾਂ ਓਲਾ ਅਤੇ ਉਬਰ ਐਪ ਜਿਹੜੀ ਹੈ ਉਹ ਲੋਕਾਂ ਵਾਸਤੇ ਬਹੁਤ ਹੀ ਕਾਰਗਰ ਸਾਬਿਤ ਹੋਈ ਹੈ ਕਿਉਂਕਿ ਇਸ ਨਾਲ ਲੋਕ ਸੁਰੱਖਿਅਤ ਵੀ ਮਹਿਸੂਸ ਕਰਦੇ ਹਨ ਅਤੇ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਬਹੁਤ ਸਸਤੇ ਅਤੇ ਸੌਖੇ ਤਰੀਕੇ ਨਾਲ ਇੱਕ ਤੋਂ ਇੱਕ ਜਗ੍ਹਾ ਤੋਂ ਦੂਜੇ ਤ ਜਗ੍ਹਾ 'ਤੇ ਪਹੁੰਚ ਜਾਂਦੇ ਹਨ ਇਹ ਐਪ ਬਹੁਤ ਹੀ ਕਾਰਗਰ ਸਾਬਿਤ ਹੋਈ ਹੈ ਅਤੇ ਇਹ ਐਪ ਸਭ ਵਾਸਤੇ ਬਹੁਤ ਹੀ ਚੰਗਾ ਸ ਲੈ ਕੇ ਆਈ ਹੈ